ਬਿਲਕੁਲ ਖੇਤੀ ਪੂਰੀ ਤਰ੍ਹਾਂ ਮੌਸਮ ਦੀ ਸਥਿਤੀਆਂ 'ਤੇ ਨਿਰਭਰ ਕਰਦੀ ਹੈ ਜਿਵੇਂ ਕਿ ਕਈ ਵਾਰ ਫਸਲ ਪੂਰੀ ਤਰ੍ਹਾਂ ਪੱਕ ਜਾਂਦੀ ਹੈ ਅਤੇ ਵੱਢਣ ਦੇ ਲਾਇਕ ਹੋ ਜਾਂਦੀ ਹੈ ਤਾਂ ਮੌਸਮ ਖਰਾਬ ਹੋ ਜਾਂਦਾ ਅਤੇ ਭਾਰੀ ਬਾਰਿਸ਼ ਆ ਜਾਂਦੀ ਹੈ ਜਿਸ ਕਰਕੇ ਪੂਰੀ ਫਸਲ ਖਰਾਬ ਹੋ ਜਾਂਦੀ ਹੈ ਅਤੇ ਇਸ ਤੋਂ ਬਾਅਦ ਨਾ ਹੀ ਸਰਕਾਰਾਂ ਮੁਆਵਜ਼ਾ ਦਿੰਦੀਆਂ ਹਨ ਅਤੇ ਨਾ ਹੀ ਕਿਸਾਨਾਂ ਦਾ ਸਾਥ ਦਿੰਦੀਆਂ ਹਨ ਇਸ ਲਈ ਸਰਕਾਰ ਨੂੰ ਗਲਤ ਕਦ ਕਿਸਾਨਾਂ ਨੂੰ ਗਲਤ ਕਦਮ ਚੁੱਕਣ ਦੇ ਲਈ ਮਜ਼ਬੂਰ ਹੋਣਾ ਪੈਂਦਾ ਹੈ ਅਤੇ ਸਰਕਾਰ ਨੂੰ ਚਾਹੀਦਾ ਹੈ ਕਿਸਾਨਾਂ ਦੇ ਲਈ ਬਣਦੇ ਹੋਰ ਯੋਜਾਨ ਯੋਜਨਾਵਾਂ ਬਣਾਈਆਂ ਜਾਣ ਤਾਂ ਜੋ ਕਿਸਾਨ ਖੇਤੀ 'ਤੇ ਆਤਮ ਨਿਰਭਰ ਹੋ ਜਾਵੇ ਅਤੇ ਇਸ ਤੋਂ ਇਲਾਵਾ ਕਾਫੀ ਕਿਸਾਨ ਹਨ ਜੋ ਕਿ ਆਪਣਾ ਘਰ ਚਲਾਉਣ ਅਤੇ ਗੁਜ਼ਾਰਾ ਕਰਨ ਦੇ ਲਈ ਖੇਤੀ ਦੇ ਨਾਲ ਨਾਲ ਡੇਰੀ ਫਾਰਮਿੰਗ ਮੱਛੀ ਪਾਲਣ ਅਤੇ ਮੁਰਗੀ ਪਾਲਣ ਦਾ ਧੰਦਾ ਕਰਦੇ ਹਨ ਸੋ ਇਹ ਇੱਕ ਉਹਨਾਂ ਦੇ ਲਈ ਥੋੜ੍ਹਾ ਜਿਹਾ ਬਿਹਤਰ ਉਪਾਅ ਹੈ ਤਾਂ ਜੋ ਬਿਲਕੁਲ ਹੀ ਖੇਤੀ 'ਤੇ ਨਿਰਭਰ ਨਾ ਹੋ ਸਕਣ ਤਾਂ ਜੋ ਆਪਣਾ ਬਚਾਅ ਕਰ ਸਕਣ ਜਦੋਂ ਫਸਲਾਂ ਬਰਬਾਦ ਹੁੰਦੀਆਂ ਹਨ